ਟਿਊਬਵੈਲ ਦੀ ਬਿਜਲੀ ਨਾਲ ਕੰਮ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਟਿਊਬਵੈਲ ਲਗਾਉਣ ਵਾਸਤੇ ਬੋਰਿੰਗ ਮਸ਼ੀਨ ਨੂੰ ਬੁਲਾਇਆ ਜਾਂਦਾ ਹੈ ਉਸ ਤੋਂ ਬਾਦ ਇੱਕ ਇੱਕ ਉਸਦਾ ਪਾਣੀ ਦੀ ਢੂੰਘਾਈ ਨਾਪ ਕੇ ਉਸ ਤੇ ਫੇਰ ਬੋਰ ਕੀਤਾ ਜਾਂਦਾ ਹੈ ਬੋਰ ਬੋਰ ਕਰਕੇ ਉਸਤੋਂ ਬਾਦ ਫੇਰ ਉਹ ਤੇ ਪੈਪਾਂ ਫਿੱਟ ਕੀਤੀਆਂ ਜਾਂਦੀਆਂ ਹਨ ਪੈਪਾਂ ਨੂੰ ਜੋੜਾਂ ਦੇ ਰਾਹੀਂ ਉਸ ਜਿੱਥੇ ਬੋਰ ਕੀਤਾ ਹੁੰਦਾ ਹੈ ਉਹ ਤੇ ਫਿੱਟ ਕੀਤਾ ਜਾਂਦਾ ਹੈ ਫਿੱਟ ਕਰਕੇ ਉਸ ਤੋਂ ਬਾਦ ਦੀ ਮੋਟਰ ਲਿਆਈ ਜਾਂਦੀ ਐ ਮੋਟਰ ਦੇ ਉੱਤੇ ਪੈਪਾਂ ਫਿੱਟ ਕਰਕੇ ਤੇ ਮੋਟਰ ਨੂੰ ਉਸ ਢੂੰਘਾਈ ਤੇ ਬੋਰ ਦੇ ਵਿੱਚ ਪਾਇਆ ਜਾਂਦਾ ਹੈ ਮੋਟਰ ਪਾ ਕੇ ਤੇ ਓਸ ਤੋਂ ਬਾਦ ਜੀ ਫੇਰ ਟਿਊਬਵੈਲ ਇਸ ਤਰੀਕੇ ਨਾਲ ਕੰਮ ਕਰਦਾ ਹੈ ਤੇ ਖੂਹ ਸਾਡੇ ਪਿੰਡ ਵਿੱਚ ਇੱਕ ਹੈਗਾ ਜੀ ਹਾਂ ਹੁਣ ਤੇ ਪੁਰਾਣਾ ਖੂਹ ਹੈ ਪਰ ਹੁਣ ਅੱਜ ਦੇ ਟਾਈਮ ਵਿੱਚ ਉਸਨੂੰ ਕੋਈ ਵੀ ਉਸਦੀ ਵਰਤੋਂ ਨਈਂ ਕਰਦਾ ਜੀ ਕਿਉਂਕਿ ਅੱਜ ਕੱਲ੍ਹ ਤੇ ਹਰ ਘਰ ਦੇ ਵਿੱਚ ਮੋਟਰ ਇਆ ਤੇ ਹਰ ਬੰਬੀਆਂ ਤੇ ਟਿਊਬਵੈਲ ਲਗਾਏ ਗਏ ਨੇ ਅੱਜ ਕੱਲ੍ਹ ਖੂਹਾਂ ਦੀ ਵਰਤੋਂ ਤਾਂ ਕੋਈ ਨੀ ਕਰਦਾ ਬਿਲਕੁਲ ਈ ਨੀ ਕਰਦਾ ਕੁਝ ਕ ਪਿੰਡ ਐਸੇ ਹੈਗੇ ਨੇ ਜਿੱਦਾਂ ਕੇ ਮਾਨਸਾ ਬਠਿੰਡੇ ਵੱਲ ਲਾ ਲੀਏ ਓਥੇ ਕਿਤੇ ਖੂਹ ਦੀ ਵਰਤੋਂ ਕੀਤੀ ਜਾਂਦੀ ਐ ਪੁਰਾਣੀ ਸੱਥਾਂ ਦੇ ਵਿੱਚ ਪੁਰਾਣੇ ਬਾਬੇ ਕਿਤੇ ਬੈਠੇ ਹੋਣ ਤਾਂ ਓਥੇ ਖੂਹਾਂ ਖਾਹਾਂ ਦਾ ਵਰਤੋਂ ਕੀਤੀ ਜਾ ਸਕਦੀ ਐ ਓਦਾਂ ਤਾਂ ਨਹੀਂ ਕਿਤੇ ਵੀ ਨੀ ਕੀਤੀ ਜਾਂਦੀ